ਜੀ ਮੇਰੇ ਕੋਲ ਅਜਿਹੇ ਵਿਅਕਤੀ ਲਈ ਵੀ ਸੁਝਾਅ ਹੈਗਾ ਵੀ ਜਿਹੜਾ ਕਿ ਸਟੈਂਪ ਸਿੱਕੇ ਚੱਟਾਨਾਂ ਇਹਨਾਂ ਨੂੰ ਇਕੱਠਾ ਕਰਨ 'ਚ ਦਿਲਚਸਪੀ ਲੱਗਦਾ ਕਿਉਂਕਿ ਮੈਂ ਖੁਦ ਇਹਨਾਂ ਨੂੰ ਇਕੱਠਾ ਕਰਨ 'ਚ ਬਹੁਤ ਦਿਲਚਸਪੀ ਰੱਖਦੀ ਹਾਂ ਮੈਨੂੰ ਬਹੁਤ ਸ਼ੌਂਕ ਹੈ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਨ ਦਾ ਸੋ ਪਹਿਲਾਂ ਤਾਂ ਹਰੇਕ ਚੀਜ਼ ਨੂੰ ਇਕੱਠਾ ਅਲੱਗ ਅਲੱਗ ਚੀਜ਼ਾਂ ਨੂੰ ਇਕੱਠਾ ਕਰਨ ਲਈ ਅਲੱਗ ਅਲੱਗ ਤਰੀਕੇ ਵਰਤੇ ਜਾਂਦੇ ਹਨ ਤਾਂ ਮੈਂ ਪਹਿਲਾਂ ਗੱਲ ਕਰੂੰਗੀ ਸਟੈਂਪ ਦੀ ਸਟੈਂਪ ਇਕੱਠੀ ਕਰਨ ਲਈ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜੇ ਸਟੈਂਪ ਹੈ ਉਹ ਸਹੀ ਹਾਲਾਤ 'ਚ ਹੋਣ ਉਹਨਾਂ ਨੂੰ ਉਹਨਾਂ ਦਾ ਸਾਈਜ਼ ਕੀ ਹੈ ਮਤਲਬ ਕਾਹਦੇ ਲਈ ਵਰਤੇ ਜਾਂਦੇ ਆ ਉਹ ਕਿਹੜੇ ਦੇਸ਼ ਦਾ ਮਤਲਬ ਕਿ ਕਿੱਧਰ ਦਾ ਸਟੈਂਪ ਕਿਹੜਾ ਹੈ ਅਤੇ ਇਹ ਸਟੈਂਪ ਆਪਾਂ ਉਹ ਤੋਂ ਵੀ ਲੈ ਸਕਦੇ ਹਾਂ ਮਤਲਬ ਆਪਣੇ ਘਰ ਜਿਹੜੇ ਪੱਤਰ ਆਉਂਦੇ ਅੱਗੇ ਰਿਸ਼ਤੇਦਾਰਾਂ ਦੇ ਜਾਂ ਕਿਸੇ ਦੇ ਆਪਾਂ ਉਹਨਾਂ ਤੋਂ ਸਟੈਂਪ ਲੈ ਸਕਦੇ ਹਾਂ ਜਾਂ ਆਪਾਂ ਕਿਤੋਂ ਮਤਲਬ ਬਾਹਰਲੇ ਦੇਸ਼ ਤੋਂ ਜਾਂ ਬਾਹਰਲੇ ਮੁਲਕ ਤੋਂ ਆਪਣੇ ਜਿਹੜੇ ਕੋਈ ਪੱਤਰ ਆ ਗਿਆ ਕੋਈ ਲੈਟਰ ਆ ਗਿਆ ਆਪਾਂ ਉਹ ਤੋਂ ਲੈ ਸਕਦੇ ਹਾਂ ਸਟੈਂਪ ਅਤੇ ਫਿਰ ਮੈਂ ਗੱਲ ਕਰਾਂਗੀ ਸਿੱਕਿਆਂ ਦੀ ਅਤੇ ਸਿੱਕਿਆਂ ਨੂੰ ਇਕੱਠਾ ਕਰਨ ਵਾਲਾ ਸ਼ੌਂਕ ਜਿਹੜਾ ਮੇਰਾ ਬਹੁਤ ਹੀ ਵਧੀਆ ਸ਼ੌਂਕ ਹੈ ਤੋ ਸਿੱਕੇ ਆਪਾਂ ਇਸ ਕਰਕੇ ਇਕੱਠੇ ਕਰ ਸਕਦੇ ਹਾਂ ਜਿਵੇਂ ਉਹਨਾਂ ਨੂੰ ਆਪਾਂ ਅਲੱਗ ਅਲੱਗ ਮਟੀਰੀਅਲ ਜਿਹੜਾ ਯੂਜ ਹੁੰਦਾ ਉਸ ਤੌਰ ਉਸ ਤੌਰ 'ਤੇ ਵੀ ਆਪਾਂ ਉਹਨਾਂ ਨੂੰ ਇਕੱਠੇ ਕਰ ਸਕਦੇ ਹਾਂ ਜਿਵੇਂ ਸਿੱਕੇ ਬਣਾਉਣ ਲਈ ਪਹਿਲਾਂ ਤਾਂਬੇ ਦੇ ਸਿੱਕੇ ਵਰਤੇ ਜਾਂਦੇ ਸਨ ਹੁਣ ਵੀ ਤਾਂਬੇ ਦੇ ਸਿੱਕੇ ਵਰਤੇ ਜਾਂਦੇ ਆ ਜਿਵੇਂ ਕਿ ਕਈ ਸੋਨਾ ਚਾਂਦੀ ਆਦਿ ਜਿਵੇਂ ਕਿਸੇ ਭਗਵਾਨ ਨੂੰ ਚੜਾਉਣ ਲਈ ਉਹ ਸਿੱਕੇ ਵਰਤੇ ਜਾਂਦੇ ਹਨ ਅਤੇ ਆ ਮੈਨੂੰ ਉਹਨਾਂ ਨੂੰ ਇਕੱਠੇ ਕਰਨ ਦਾ ਬਹੁਤ ਸ਼ੌਂਕ ਹੈ ਤੁਸੀਂ ਵੀ ਕਰ ਸਕਦੇ ਹੋ ਇਕੱਠੇ ਕਿਉਂਕਿ ਤਾਂਬੇ ਦੇ ਸਿੱਕੇ ਵੀ ਬਹੁਤ ਵਧੀਆ ਹੁੰਦੇ ਹਨ ਉਹਨੂੰ ਇਕੱਠੇ ਕਰ ਸਕਦੇ ਹਾਂ ਤੀਸਰਾ ਮੈਂ ਦੱਸ ਸਕਦੀ ਹਾਂ ਚੱਟਾਨਾਂ ਬਾਰੇ ਪਹਿਲਾਂ ਤਾਂ ਚੱਟਾਨਾਂ ਨੂੰ ਇਕੱਠੇ ਕਰਨ ਲਈ ਪਹਿਲਾਂ ਸਧਾਰਨ ਚੱਟਾਨਾਂ ਦਾ ਆਪਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਆ ਸਧਾਰਨ ਚੱਟਾਨਾਂ ਜਿਵੇਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਸੀ ਰੰਗ ਦੇ ਤੌਰ 'ਤੇ ਜਿਵੇਂ ਪਹਿਲਾਂ ਮੈਂ ਰੰਗ ਦੇ ਤੌਰ 'ਤੇ ਵੰਡਿਆ ਸੀ ਉਹਨਾਂ ਨੂੰ ਜਿਵੇਂ ਮੈਂ ਚਿੱਟੇ ਚੱਟਾਨਾਂ ਨੂੰ ਅਲੱਗ ਨੀਲੇ ਐਵੇਂ ਪੀਲੇ ਐਵੇਂ ਚੱਟਾਨਾਂ ਅਲੱਗ ਤਰ੍ਹਾਂ ਨਾਲ ਵੰਡੀਆਂ ਸੀਗੀਆਂ ਉਸ ਤਰ੍ਹਾਂ ਅਤੇ ਚੱਟਾਨਾਂ ਨੂੰ ਇਕੱਠੇ ਕਰਨ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਿਹੜੇ ਚੱਟਾਨ ਜਿਹੜੀ ਸਧਾਰਨ ਹੈ ਅਤੇ ਕਿਹੜੀ ਚੱਟਾਨ ਦੀ ਕੀਮਤ ਕੀ ਹੈ ਕਿਉਂਕਿ ਇੱਕ ਹਰੇਕ ਚੱਟਾਨ ਜਿਹੜੀ ਹੈ ਕੀਮਤੀ ਨਹੀਂ ਹੁੰਦੀ ਅਤੇ ਹਰੇਕ ਚੱਟਾਨ ਵੀ ਸਧਾਰਨ ਨਹੀਂ ਹੁੰਦੀ ਤਾਂ ਕਰਕੇ ਉਸਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਵੀ ਕਿਹੜੀ ਚੱਟਾਨ ਕਿਹੜੀ ਕੀਮਤ ਰੱਖਦੀ ਆ ਜਾਂ ਕਿਹੜੀ ਸਧਾਰਨ ਹੈ ਜਿਵੇਂ ਕਿ ਹੁਣ ਚੱਟਾਨਾਂ ਮੈਨੂੰ ਜਿਹੜੀ ਪਤਾ ਉਹ ਜਿਵੇਂ ਗਲਾਸ ਕਲੇ ਐਗਿਟ ਐਗਿਟ ਜਿਹੜਾ ਹੈਗਾ ਬਹੁਤ ਹੀ ਮਸ਼ਹੂਰ ਚੱਟਾਨ ਹੈ ਬਹੁਤ ਹੀ ਕੀਮਤੀ ਵੀ ਹੈ ਇਹ ਸੋ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਨ ਲਈ ਆਪਣੀ ਨੌਲੇਜ ਹੋਣੀ ਚਾਹੀਦੀ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਨੂੰ ਆਪਾਂ ਕਿਸ ਤਰੀਕੇ ਨਾਲ ਇਕੱਠੀ ਕਰਨੀ ਆ ਸੋ ਮੈਂ ਤਾਂ ਇੰਨਾ ਕੁ ਕਹਿਣਾ ਚਾਹਵਾਂਗੀ ਧੰਨਵਾਦ